ਇੱਕ ਜਨਵਰੀ ਦੋ ਹਜ਼ਾਰ ਪੰਜ ਤੇਰ੍ਹਾਂ ਅਗਸਤ ਦੋ ਹਜ਼ਾਰ ਪੰਜ ਇੱਕ ਅਪ੍ਰੈਲ ਉੱਨੀ ਸੌ ਸਤਾਹਠ ਤੇਈ ਦਸੰਬਰ ਦੋ ਹਜ਼ਾਰ ਸੌਲ੍ਹਾਂ ਤੀਹ ਮਾਰਚ ਦੋ ਹਜ਼ਾਰ ਅੱਠ